ਮੈਂ ਜਦੋਂ ਸਕੂਲ ਵਿੱਚ ਹੁੰਦਾ ਸੀ ਉਦੋਂ ਮੈਂ ਮੇਰੇ ਸਕੂਲ ਵਿੱਚ ਲੱਗੀ ਇੱਕ ਚਿੱਤਰਕਾਰੀ ਦੀ ਵਰਕਸ਼ਾਪ ਨੂੰ ਜੁਆਇਨ ਕੀਤਾ ਸੀ ਉਸ ਵਰਕਸ਼ਾਪ ਵਿੱਚ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਹੀ ਗੱਲ ਸਿਖਾਈ ਕਿ ਕੋਈ ਵੀ ਚਿੱਤਰਕਾਰ ਵਾਸਤੇ ਉਸਦੇ ਬੇਸਿਕ ਪ੍ਰਿੰਸੀਪਲਜ਼ ਜਾਣਨੇ ਬਹੁਤ ਜ਼ਰੂਰੀ ਹਨ ਅਗਰ ਚਿੱਤਰਕਾਰ ਚਿੱਤਰਕਾਰੀ ਦੇ ਬੇਸਿਕ ਪ੍ਰਿੰਸੀਪਲਜ਼ ਜਾਣਦਾ ਹੈ ਤਾਂ ਉਹ ਅੱਗੇ ਕੁਛ ਵੀ ਬਣਾ ਸਕਦਾ ਹੈ ਅਤੇ ਮੈਂ ਇੱਕ ਹੋਰ ਗੱਲ ਸਿੱਖੀ ਕਿ ਹ ਸਾਨੂੰ ਚਿੱਤਰਕਾਰੀ ਅਗਰ ਆਪਣੀ ਇੰਪਰੂਵ ਕਰਨੀ ਹੈ ਤਾਂ ਸਾਨੂੰ ਰੋਜ਼ ਕੁਛ ਨਾ ਕੁਛ ਚਿੱਤਰਕਾਰੀ ਕਰਨੀ ਚਾਹੀਦੀ ਹੈ ਉਹ ਕੁਛ ਵੀ ਹੋ ਸਕਦਾ ਹੈ ਜਿੱਦਾਂ ਕਿ ਸਾਡੇ ਸਾਹਮਣੇ ਵਾਲਾ ਮਕਾਨ ਕੋਈ ਪੇੜ ਕੋਈ ਅਸਮਾਨ ਵਿੱਚ ਕੋਈ ਦਿਖਿਆ ਪੰਛੀ ਅਸੀਂ ਕੁਛ ਵੀ ਬਣਾ ਸਕਦੇ ਹਾਂ ਅ ਬਸ ਇੰਨਾ ਚਾਹੀਦਾ ਹੈ ਕਿ ਰੋਜ਼ ਕੁਛ ਨਾ ਕੁਛ ਚਿੱਤਰਕਾਰੀ ਕਰਨੀ ਹੈ ਤਾਂ ਜੋ ਸਾਡੀ ਚਿੱਤਰਕਾਰੀ ਇੰਪਰੂਵ ਹੋ ਸਕੇ